ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਰ ਦੂਰਦਰਸ਼ੀ ਸਰ ਬੋਲ ਰਹੇ ਜੀ ਹਾਂਜੀ ਮੈ ਨਾ ਸਰ ਆਪਣੀ ਰਾਧੇ ਸ਼ਾਮ ਜੀ ਹੈਗੇ ਹੈ ਕੋਮਨ ਫਰੈਂਡ ਉਹਨਾਂ ਦੇ ਰੈਫਰੰਸ ਤੋਂ ਬੋਲ ਰਿਹਾ ਉਹਨਾਂ ਨੇ ਤੁਹਾਡਾ ਨੰਬਰ ਦਿੱਤਾ ਸੀਗਾ ਅਤੇ ਮੈਂ ਸਰ ਇਹਦੇ ਨਾ ਲਾਸਟ ਵੀਕ ਪਟਿਆਲਾ ਸ਼ਿਫਟ ਹੋਇਆ ਜੋਬ ਦੇ ਸਿਲਸਿਲੇ 'ਚ ਅਤੇ ਮੇਰਾ ਫਿਰ ਨਾ ਐਚੁਲੀ ਟੂਰਿੰਗ ਜੋਬ ਹੈ ਅਤੇ ਮੈਂ ਪੰਜਾਬ ਦੇ ਵਿੱਚ ਮੂਵ ਕਰਦਾ ਰਹਿੰਦਾ ਪੰਜਾਬ ਰੀਜਨ ਮੈਨੂੰ ਮਿਲਿਆ ਹੋਇਆ ਜੋਬ ਦੇ ਰਿਗਾਰਡਿੰਗ ਅਤੇ ਮੈਂ ਇਹ ਕਨਫਰਮ ਕਰਨਾ ਸੀ ਵੀ ਕਿਉਂਕਿ ਤੁਸੀਂ ਇੱਥੇ ਰੈਜੀਡੈਂਸ ਪੁਰਾਣੇ ਰਹਿ ਰਹੇ ਓਂ ਤਾਂ ਕਾਇੰਡਲੀ ਮੈਨੂੰ ਗਾਈਡ ਕਰੋ ਕਿ ਵੀ ਇੱਧਰ ਮੈਂ ਕੋਈ ਅਲੱਗ ਅਲੱਗ ਸ਼ਹਿਰਾਂ 'ਚ ਡਿਸਟ੍ਰਿਕ ਜਾਣਾ ਹੋਵੇ ਪੰਜਾਬ ਦੇ ਜਿਵੇਂ ਅੰਮ੍ਰਿਤਸਰ ਇੱਧਰੋਂ ਪਾਸੇ ਚੰਡੀਗੜ੍ਹ ਹੋ ਗਿਆ ਉੱਧਰ ਲੁ ਬਠਿੰਡਾ ਹੋ ਗਿਆ ਅਤੇ ਆਉਣ ਜਾਣ ਦੇ ਕੀ ਟ੍ਰਾਂਸਪੋਰਟ ਦੇ ਕੀ ਕੀ ਸਾਧਨ ਹੈ ਢਾਈ ਸੌ ਠੀਕ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ

ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂ ਫਿਰ ਉੱਥੋਂ ਟ੍ਰੇਨ ਦੀ ਵੀ ਹੋਏਗੀ ਹੈ ਨਾ ਉੱਧਰੋਂ ਅਗਰ ਸਰਹੰਦ ਤੋਂ ਟ੍ਰੇਨ 'ਤੇ ਵੀ ਜਾ ਸਕਦੇ ਆ ਨਾ ਹਾਂ ਠੀਕ ਹੈ ਜੀ ਠੀਕ ਹੈ ਅਤੇ ਇਹ ਜਿਹੜਾ ਇਹ ਜਾਂਦੇ ਹੋਏ ਫਿਰ ਆਪਣਾ ਜਲੰਧਰ ਅਤੇ ਲੁਧਿਆਣਾ ਵੀ ਮਤਲਬ ਔਨ ਦਾ ਵੇ ਹੈ ਨਾ ਅੰਮ੍ਰਿਤਸਰ ਤੋਂ ਜਾਂਦੇ ਹਾਂ ਆਪਾਂ ਜਦੋਂ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਸਰ ਅਤੇ ਇੱਧਰੋਂ ਅਗਰ ਬਠਿੰਡਾ ਵਗੈਰਾ ਜਾਣਾ ਹੋਵੇ ਇੱਧਰ ਇਸ ਇਸ ਬੈਲਟ ਅਤੇ ਮਾਲਵਾ ਬੈਲਟ 'ਚ

ਅੱਛਾ ਇੱਥੇ ਓਲਾ ਵਗੈਰਾ ਚਲਦੀ ਹੈ ਮਤਲਬ ਆਪਣੇ ਪਟਿਆਲੇ 'ਚ ਹੈਗੀ ਆ ਓਲਾ ਸਰਵਿਸ ਜ਼ਿਆਦਾ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਵਨ ਵੇਅ ਸਰ ਠੀਕ ਹੈ ਠੀਕ ਹੈ ਠੀਕ ਹੈ ਸਰ ਠੀਕ ਹੈ ਜੀ ਹਾਂਜੀ ਹਾਂਜੀ ਹਾਂ ਬਸ ਬਾਏ ਰੋਡ ਹੀ ਜਾ ਸਕਦੇ ਹੈ ਨਾ ਵੀ

ਠੀਕ ਹੈ ਜੀ ਠੀਕ ਹੈ ਸਰ ਹਾਂਜੀ ਹਾਂਜੀ ਹਾਂ ਬਿਲਕੁਲ ਸਰ ਬਿਲਕੁਲ ਹਾਂਜੀ ਹਾਂਜੀ ਹਾਂਜੀ ਹਾਂ ਬੈਟਰ ਹੈ ਸਰਵਿਸ ਬਿਲਕੁਲ ਮੈਂ ਯੂਜ ਵੀ ਕੀਤੀ ਹੋਈ ਹੈ ਠੀਕ ਆ ਸਰ ਬਾਹਲੀ ਹਾਂਜੀ ਹਾਂਜੀ

ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਸਰ ਓਕੇ ਜੀ ਥੈਂਕ ਯੂ ਸਰ ਥੈਂਕ ਯੂ ਸੋ ਨਾਈਸ ਆਫ ਯੂ ਹਾਂ ਸਰ ਮੈਂ ਤੁਹਾਨੂੰ ਫਿਰ ਜਦੋਂ ਕੋਈ ਹੋਰ ਲੋੜ ਹੋਈ ਤਾਂ ਮੈਂ ਜ਼ਰੂਰ ਤੁਹਾਡੇ ਨਾਲ ਕੋਂਟੈਕਟ ਕਰਾਂਗਾ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਸਰ ਗੁੱਡ ਡੇ ਸਰ ਠੀਕ ਹੈ ਜੀ